ਮੈਨੂੰ ਰਿਵਾਇਤੀ ਤੌਰ 'ਤੇ ਪੈੱਨ ਨਾਲ ਕਾਗਜ਼ 'ਤੇ ਲਿਖਣਾ ਜ਼ਿਆਦਾ ਪਸੰਦ ਨਹੀਂ ਪਰ ਮੈਨੂੰ ਕਾਲਜ ਦੇ ਨੋਟਸ ਬਣਾਉਣੇ ਪੈਂਦੇ ਹਨ ਇਸ ਲਈ ਮੈਨੂੰ ਲਿਖਣਾ ਪੈਂਦਾ ਹੈ ਪੁਰਾਣੇ ਸਮੇਂ ਵਿੱਚ ਗੱਲਬਾਤ ਕਰਨ ਦਾ ਸਾਧਨ ਚਿੱਠੀ ਹੁੰਦੀ ਸੀ ਅਤੇ ਇਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਣ ਤੱਕ ਵੀ ਟਾਈਮ ਲੱਗਦਾ ਸੀ ਅਤੇ ਇਸ ਦਾ ਇੰਤਜ਼ਾਰ ਬਹੁਤ ਲੰਬਾ ਹੁੰਦਾ ਸੀ ਪਰ ਅੱਜ ਕੱਲ੍ਹ ਦੇ ਦੌਰ ਵਿੱਚ ਮੋਬਾਇਲ ਅਤੇ ਲੈਪਟੋਪ ਆ ਗਏ ਹਨ ਇਹਨਾਂ ਨਾਲ ਮੈਸੇਜ ਟਾਈਪ ਕਰਦਿਆਂ ਹੀ ਉਸੇ ਵਕਤ ਮੈਸੇਜ ਪਹੁੰਚ ਜਾਂਦਾ ਹੈ ਅਤੇ ਇਸ ਤਰ੍ਹਾਂ ਗੱਲਬਾਤ ਕਰਨ ਦਾ ਵੀ ਮਜ਼ਾ ਆਉਂਦਾ ਹੈ ਅਤੇ ਕੋਈ ਵੀ ਸੁਨੇਹਾ ਭੇਜਣਾ ਹੋਵੇ ਤਾਂ ਜਲਦੀ ਹੀ ਪਹੁੰਚ ਜਾਂਦਾ ਹੈ ਇਸ ਤਰ੍ਹਾਂ ਸਭ ਨੂੰ ਅ ਲਿਖਣ ਦਾ ਰੁਝਾਨ ਘੱਟ ਗਿਆ ਅਤੇ ਮੋਬਾਇਲ ਫੋਨ ਅਤੇ ਲੈਪਟੋਪ 'ਤੇ ਟਾਈਪ ਕਰਨ ਦਾ ਰੁਝਾਨ ਵੱਧ ਗਿਆ